ਮੈਂ ਭਗਤ ਸਿੰਘ ਦੇ ਜੀਵਨੀ ਉੱਤੇ ਇੱਕ ਕਿਤਾਬ ਪੜ੍ਹੀ ਉਹ ਕਿਤਾਬ ਭਗਤ ਸਿੰਘ ਦੇ ਜੀਵਨ ਉੱਤੇ ਅਧਾਰਿਤ ਹੈ ਉਸ ਵਿੱਚ ਦੱਸਿਆ ਗਿਆ ਹੈ ਕਿ ਭਗਤ ਸਿੰਘ ਜਲ੍ਹਿਆਵਾਲ਼ੇ ਬਾਗ ਦੇ ਸਾਕੇ ਤੋਂ ਬਹੁਤ ਪ੍ਰਭਾਵਿਤ ਸੀ ਜੋ ਕਿ ਉੱਨੀ ਸੌ ਉੱਨੀ ਵਿੱਚ ਹੋਇਆ ਸੀ ਅਤੇ ਉੱਨੀ ਸੌ ਉਨੱਤੀ ਵਿੱਚ ਉਹਨਾਂ ਨੇ ਵਿਧਾਨ ਸਭਾ ਵਿੱਚ ਬੰਬ ਸਿੱਟਿਆ ਸੀ ਦਿੱਲੀ ਵਿੱਚ ਜਿਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਅਤੇ ਉਹਨਾਂ ਨੇ ਜਦੋਂ ਜੇਲ੍ਹ ਵਿੱਚ ਰਹੇ ਤਾਂ ਉੱਥੇ ਭੁੱਖ ਹੜਤਾਲ ਵੀ ਕੀਤੀ ਸੀ ਕਿ ਜੇਲਰਾਂ 'ਚ ਰਹਿ ਰਹੇ ਕੈਦੀਆਂ ਨੂੰ ਚੰਗੇ ਆ ਚੰਗਾ ਵਰਵਾਰ ਵਿਵਹਾਰ ਕੀਤਾ ਜਾਣਾ ਚਾਹੀਦਾ ਉਹਨਾਂ ਨਾਲ਼ ਅਤੇ ਆਖਰਕਾਰ ਉੱਨੀ ਸੌ ਇਕੱਤੀ ਵਿੱਚ ਲਾਹੌਰ ਸੈਂਟਰ ਜੇਲ੍ਹ ਵਿੱਚ ਉਹਨਾਂ ਨੂੰ ਉਹਨਾਂ ਦੇ ਦੋ ਸਾਥੀਆਂ ਨਾਲ਼ ਫਾਂਸੀ ਦਿੱਤੀ ਗਈ ਸੀ ਅਤੇ ਉਸ ਦਿਨ ਨੂੰ ਉਹਨਾਂ ਦਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਵੈਸੇ ਉਸ ਕਿਤਾਬ ਵਿੱਚ ਭਗਤ ਸਿੰਘ ਦੇ ਕਾਫੀ ਵਿਚਾਰ ਪੇਸ਼ ਕੀਤੇ ਗਏ ਹਨ ਜਿਵੇਂ ਕਿ ਭਗਤ ਸਿੰਘ ਭਗਤ ਸਿੰਘ ਰਾਸ਼ਟਰਵਾਦੀ ਇੱਕ ਰਾਸ਼ਟਰਵਾਦੀ ਸੀ ਉਹਨਾਂ ਨੇ ਹਮੇਸ਼ਾ ਅਜ਼ਾਦੀ ਆਜ਼ਾਦ ਭਾਰਤ ਬਾਰੇ ਗੱਲ ਕੀਤੀ ਆਪਣੇ ਵਿਚਾਰ ਪੇਸ਼ ਕੀਤੇ ਹਮੇਸ਼ਾ ਅੰਗਰੇਜ਼ ਅੰਗਰੇਜ਼ ਰਾਜ ਦੇ ਵਿਰੁੱਧ ਗੱਲ ਕੀਤੀ ਭਗਤ ਸਿੰਘ ਦੀ ਸੋਚ ਕਾਫੀ ਸੈਕਲਰਿਸਟ ਸੀ ਭਾਵ ਮਤਲਬ ਕਿ ਹਰ ਧਰਮ ਹਰ ਬੈਕਗਰਾਊਂਡ ਦੇ ਲੋਕ ਇੱਕ ਇੱਕ ਸਾਥ ਰਹਿਣ ਅਤੇ ਕੋਈ ਵੀ ਭੇਦ ਭਾਵ ਨਾ ਹੋਵੇ ਉਹਨਾਂ ਨਾਲ਼ ਭਗਤ ਸਿੰਘ ਇੱਕ ਇਨਕਲਾਬੀ ਵੀ ਸੀ ਮਤਲਬ ਅੰਗਰੇਜ਼ ਅੰਗਰੇਜ਼ੀ ਰਾਜ ਦੇ ਵਿੱਚ ਹਮੇਸ਼ਾ ਅੰਗਰੇਜ਼ੀ ਰਾਜ ਦੇ ਵਿੱਚ ਹਮੇਸ਼ਾ ਉਹਨਾਂ ਦੇ ਖਿਲਾਫ ਹੀ ਗੱਲ ਕੀਤੀ ਉਹਨਾਂ ਦਾ ਮੰਨਣਾ ਸੀ ਕਿ ਭਾਵੇਂ ਵਾਏਲੇਸ਼ਨ ਦੀ ਵਰਤੋਂ ਕਰਨੀ ਪਵੇ ਪਰ ਆਜ਼ਾਦੀ ਲੈ ਕੇ ਹੀ ਰਹਿਣਾ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਨੌਜਵਾਨਾਂ ਨੂੰ ਬਹੁਤ ਉਤਸ਼ਾਹਿਤ ਵੀ ਕੀਤਾ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਆਜ਼ਾਦੀ ਸਟ੍ਰੱਗਲ ਵਿੱਚ ਹਿੱਸਾ ਲੈਂਦੇ ਸੀ ਮੈਂ ਇੱਕ ਇੱਕ ਵਾਰ ਇੱਕ ਰੀਡਿੰਗ ਕਲੱਬ ਵਿੱਚ ਸ਼ਾਮਿਲ ਹੋਇਆ ਸੀ ਜਿਸ ਮੇਰਾ ਮੰਨਣਾ ਏ ਕਿ ਉਸ ਕਲੱਬ ਰੀਡਿੰਗ ਕਲੱਬਾਂ ਵਿੱਚ ਜਾਣ ਨਾਲ਼ ਸਾਨੂੰ ਰੀਡਿੰਗ ਦੇ ਤਰਫ ਇੰਸਪਰੇਸ਼ਨ ਮਿਲਦੀ ਹੈ ਅਤੇ ਸਾਨੂੰ ਜਾਣਾ ਚਾਹੀਦਾ ਹੈ